ਹੈਲੋ ਕਿਸ ਤਰ੍ਹਾਂ ਆਉਣਾ ਹੋਇਆ ਮੈਡਮ ਜੀ ਤੁਹਾਨੂੰ ਮੈਂ ਕਿਹਾ ਕਿਸ ਤਰ੍ਹਾਂ ਆਉਣਾ ਹੋਇਆ ਤੁਹਾਨੂੰ ਅੱਛਾ ਮੈਡਮ ਜੀ ਕਿਹੜਾ ਫਰੂਟ ਲੈਣਾ ਤੁਸੀਂ ਜੀ ਅੱਛਾ ਜੀ ਕੋਈ ਨਹੀਂ ਮੈਡਮ ਜੀ ਦੱਸੋ ਤੁਸੀਂ ਲਾ ਦਿੰਦੇ ਹਾਂ ਕੇਲੇ ਸੱਤਰ ਰੁਪਏ ਦਰਜਨ ਜੀ ਅੰਗੂਰ ਹੈਗੇ ਆ ਅੱਸੀ ਰੁਪਏ ਕਿੱਲੋ ਅਤੇ ਸੇਬ ਹੈਗੇ ਮੈਡਮ ਜੀ ਦੋ ਸੌ ਰੁਪਏ ਕਿੱਲੋ ਕੋਈ ਨਾ ਮੈਡਮ ਜੀ ਕਰ ਦਿੰਦੇ ਹਾਂ ਜੇ ਤੁਸੀਂ ਲੈਣੇ ਆ ਤਾਂ ਘੱਟ ਕਰ ਦਿੰਦੇ ਹਾਂ ਠੀਕ ਹੈ ਨਾ ਜੇ ਤੁਸੀਂ ਰੇਟ ਹੀ ਪੁੱਛਣਾ ਤਾਂ ਫਿਰ ਰਹਿਣ ਦਿਓ ਕੋਈ ਨਹੀਂ ਜੇ ਤੁਸੀਂ ਲੈਣਾ ਫਰੂਟ ਤਾਂ ਕੋਈ ਨਹੀਂ ਸੇਬ ਤੁਸੀਂ ਦੋ ਸੌ ਰੁਪਈਆ ਤੁਸੀਂ ਚਲੋ ਵੀਹ ਘੱਟ ਦੇ ਦਿਓ ਅਤੇ ਕੇਲੇ ਸੱਤਰ ਰੁਪਈਆ ਤੁਸੀਂ ਸੱਠ ਰੁਪਏ ਦੇ ਦਿਓ ਅਤੇ ਅੰਗੂਰ ਅੱਸੀ ਰੁਪਈਆ ਤਾਂ ਉਹ ਤੁਸੀਂ ਸੱਤਰ ਦੇ ਦਿਓ ਠੀਕ ਹੈ ਨਾ ਠੀਕ ਹੈ ਮੈਡਮ ਜੀ ਇਹ ਲਓ ਮੈਡਮ ਜੀ ਫੜੋ ਆਪਣਾ ਫਰੂਟ